ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ

ਮੈਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਤਿਹਗੜ੍ਹ ਸਾਹਿਬ 'ਚ ਸਾਡੇ ਇੱਥੇ ਜੀ ਚਾਰ ਗੁਰਦੁਆਰਾ ਸਾਹਿਬ ਨੇ ਜੋ ਮੇਨ ਨੇ ਇੱਕ ਆਪਣਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਆ ਮੇਨ ਗੁਰਦੁਆਰਾ ਸਾਹਿਬ 'ਚ ਉਸਦੇ ਨਾਲ ਠੰਡਾ ਬੁਰਜ ਹੈ ਅਤੇ ਉਸ ਤੋਂ ਬਾਅਦ ਆ ਜਾਂਦਾ ਆਪਣਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਇੱਕ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਅਤੇ ਇੱਕ ਗੁਰਦੁਆਰਾ ਸੀਸਗੰਜ ਸਾਹਿਬ ਹੈ ਉਹਦੇ ਸਾਹਮਣੇ ਹੀ ਆ ਹਾਂਜੀ ਕਚਹਿਰੀਆਂ ਦੇ ਸਾਹਮਣੇ ਓਕੇ ਠੀਕ ਹੈ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਆਪਣਾ ਐਂ ਜਿਹੜੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਇਹ ਬਣੇ ਹੋਏ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਹੜੇ ਦੋ ਛੋਟੇ ਸਾਹਿਬਜ਼ਾਦੇ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਜੋ ਕਿ ਉਰੇ ਸਰਹਿੰਦ ਵਿੱਚ ਪਹਿਲੇ ਸਾਰਾ ਸਰਹਿੰਦ ਦਾ ਪਾਰਟ ਸੀਗਾ ਅਤੇ ਸਰਹਿੰਦ ਵਿੱਚ ਪਹਿਲੇ ਵਜ਼ੀਰ ਖਾਂ ਜਦੋਂ ਮੁਗਲ ਸਾਮਰਾਜ ਦੇ ਟਾਇਮ 'ਤੇ ਵਜ਼ੀਰ ਖਾਂ ਦਾ ਰਾਜ ਹੁੰਦਾ ਸੀਗਾ ਅਤੇ ਉੱਥੇ ਉਸ ਤੋਂ ਬਾਅਦ ਉਹਨੇ ਜਦੋਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਕੈਦ ਕਰਕੇ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀਗਾ ਅਤੇ ਉੱਥੇ ਹੀ ਹੁਣ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨੀਚੇ ਭੋਰਾ ਸਾਹਿਬ ਆ ਉੱਥੇ ਉਹੀ ਕੰਧਾਂ ਵੀ ਨੇ ਜਿੱਥੇ ਗਰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਅਤੇ ਉਹਨਾਂ ਦਾ ਸੰਸਕਾਰ ਜਿਹੜਾ ਹੈ ਉਹ ਹੋਇਆ ਜਿੱਥੇ ਅਸਥਾਨ 'ਤੇ ਉਹਦਾ ਨਾਮ ਹੈ ਉੱਥੇ ਹੁਣ ਗੁਰਦੁਆਰਾ ਜਿਹੜਾ ਬਣਿਆ ਹੋਇਆ ਉਹ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਉੱਥੇ ਵਜ਼ੀਰ ਖਾਂ ਨੇ ਜਦੋਂ ਸੰਸਕਾਰ ਕਰਨਾ ਸੀਗਾ ਉਸ ਟਾਇਮ ਉਹਨੇ ਸ਼ਰਤ ਰੱਖੀ ਸੀਗੀ ਜਿਹੜਾ ਵੀ ਸੰਸਕਾਰ ਕਰਨਾ ਚਾਹੁੰਦਾ ਉਹ ਖੜ੍ਹੀਆਂ ਮੋਹਰਾਂ ਕਰਕੇ ਤਾਂ ਉਹ ਜ਼ਮੀਨ ਮੁੱਲ ਖਰੀਦੇਗਾ ਫਿਰ ਉਹ ਲਾਗੇ ਪਿੰਡ ਦਾ ਦੀਵਾਨ ਟੋਡਰ ਮੱਲ ਸੀਗਾ ਉਸ ਟਾਈਮ ਦੇ ਬਹੁਤ ਹੀ ਅਮੀਰ ਬੰਦਿਆਂ 'ਚੋਂ ਇੱਕ ਸੀਗਾ ਅਤੇ ਉਹਨੇ ਖੜ੍ਹੀਆਂ ਮੋਹਰਾਂ ਕਰਕੇ ਓਨੀ ਕੁ ਜ਼ਮੀਨ ਜਿਹੜੀ ਮੁੱਲ ਲਈ ਸੀ ਫਿਰ ਮਾਤਾ ਗੁਜਰੀ ਜੀ ਉਨ੍ਹਾਂ ਨੂੰ ਮਾਤਾ ਗੁਜਰ ਕੌਰ ਜੀ ਵੀ ਕਹਿੰਦੇ ਆ ਅਤੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕੀਤਾ ਸੀਗਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਅਤੇ ਇੱਕ ਐਵੇਂ ਹੀ ਹਿਸਟਰੀ 'ਚ ਇੱਕ ਮਿਸਾਲ ਹੈ ਕਿ ਆਹ ਜਿਹੜਾ ਗੁਰਦੁਆਰਾ ਸਾਹਿਬ ਦੀ ਜਿਹੜੀ ਜ਼ਮੀਨ ਹੈ ਉਹ ਸਭ ਤੋਂ ਮਹਿੰਗੀ ਮੰਨੀ ਜਾਂਦੀ ਹੈ ਹਾਂਜੀ

ਗੁਰਦੁਆਰਾ ਸੀਸਗੰਜ ਸਾਹਿਬ ਦੇ ਉੱਤੇ ਆਪਣਾ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਆ ਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਉਦੋਂ ਉੱਥੇ ਕਾਫੀ ਸਿੰਘ ਸ਼ਹੀਦ ਹੋਏ ਸੀਗੇ ਉੱਥੇ ਅ ਸੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਅਤੇ ਜਿਹੜਾ ਠੰਢਾ ਬੁਰਜ ਆ ਉੱਥੇ ਮਾਤਾ ਜੀ ਸ਼ਹੀਦ ਹੋਏ ਸੀਗੇ

ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ